ਸਤਿ ਸ਼੍ਰੀ ਅਕਾਲ ਜੀ ਮੈਂ ਹੋਰ ਭਾਸ਼ਾ ਵਿੱਚ ਕਿਸੇ ਨਾਲ ਸੰਚਾਰ ਅਨੁਵਾਦ ਕਰਨ ਲਈ ਡੁਲਿੰਗੋ ਐਪ ਦੀ ਵਰਤੋਂ ਕੀਤੀ ਸੀ ਜੋ ਕਿ ਐਪ ਬਹੁਤ ਹੀ ਵਧੀਆ ਸੀ ਮੈਨੂੰ ਅੰਗਰੇਜ਼ੀ ਵਿੱਚ ਬੋਲਣ ਜਾਂ ਸਮਝਣ ਵਿੱਚ ਬਹੁਤ ਸਾਰੀ ਦਿੱਕਤ ਆਉਂਦੀ ਸੀ ਪਰ ਜਦੋਂ ਮੈਂ ਗੂਗਲ ਤੋਂ ਡੁਲਿੰਗੋ ਐਪ ਡਾਊਨਲੋਡ ਕੀਤੀ ਤਾਂ ਮੈਨੂੰ ਇਸ ਦੇ ਫੀਚਰਸ ਬਾਰੇ ਪਤਾ ਲੱਗਿਆ ਡੁਲਿੰਗੋ ਐਪ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਆਸਾਨੀ ਨਾਲ ਸਮਝਾਉਣ ਵਿੱਚ ਮਦਦ ਕੀਤੀ ਡੁਲਿੰਗੋ ਐਪ ਨੇ ਮੈਨੂੰ ਜ਼ੀਰੋ ਤੋਂ ਸਿਖਾਉਣਾ ਸਟਾਰਟ ਕੀਤਾ ਹੁਣ ਮੈਂ ਇਸਦੀ ਵਰਤੋਂ ਕਰਦੀ ਹਾਂ ਡੁਲਿੰਗੋ ਐਪ ਨਾਲ ਮੈਂ ਹੁਣ ਵਧੀਆ ਇੰਗਲਿਸ਼ ਬੋਲ ਵੀ ਸਕਦੀ ਹਾਂ ਅਤੇ ਸਮਝ ਵੀ ਸਕਦੀ ਹਾਂ ਇਸ ਦੀ ਵਰਤੋਂ ਕਰਨ ਨਾਲ ਮੈਂ ਹਰ ਕਿਸੇ ਨਾਲ ਵਧੀਆ ਇੰਗਲਿਸ਼ ਵਿੱਚ ਗੱਲਬਾਤ ਕਰਨਾ ਚਾਹੁੰਦੀ ਹਾਂ ਕਰ ਸਕਦੀ ਹਾਂ ਇਹ ਮੇਰੇ ਲਈ ਬਹੁਤ ਹੀ ਫਾਇਦੇਮੰਦ ਐਪ ਸੀ ਧੰਨਵਾਦ